ਸਤਿ ਸ਼੍ਰੀ ਅਕਾਲ ਅੰਕਲ ਜੀ ਤੁਸੀਂ ਢਿੱਲੋ ਕੈਬ ਏਜੰਸੀ ਤੋਂ ਬੋਲਦੇ ਪਏ ਹੋ ਮੈਂ ਨਾ ਐਕਚੁਅਲੀ ਕੈਬ ਬੁਕ ਕਰਵਾਉਣੀ ਸੀਗੀ ਮੇਰੀ ਮਾਤਾ ਜੀ ਨੇ ਆਉਣਾ ਹੈ ਮੇਰੇ ਕੋਲੋਂ ਜਲੰਧਰ ਤੋਂ ਉਹਨਾਂ ਨੇ ਲੁਧਿਆਣਾ ਆਉਣਾ ਤਾਂ ਮੈਂ ਇੱਕ ਕੈਬ ਬੁੱਕ ਕਰਵਾਉਣੀ ਸੀ ਕੈਬ ਵਧੀਆ ਹੋਣੀ ਚਾਹੀਦੀ ਆ ਸਾਫ ਸੁਥਰੀ ਉਹ ਡਰਾਈਵਰ ਵੀ ਵਧੀਆ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਜਿੱਦਾਂ ਕਿ ਉਹ ਬਜ਼ੁਰਗ ਲੋਕ ਹੈ ਤਾਂ ਉਹਨਾਂ ਨੂੰ ਥੋੜ੍ਹੀ ਪ੍ਰੋ ਉਹਨਾਂ ਨੂੰ ਥੋੜ੍ਹੀ ਸਮੱਸਿਆ ਹੁੰਦੀ ਹੈ ਇੱਦਾਂ ਆਉਣ ਜਾਣ ਲਈ ਇਸ ਕਰਕੇ ਉਹਨਾਂ ਨੇ ਮੈਨੂੰ ਕਿਹਾ ਕਿ ਵਧੀਆ ਕੈਬ ਹੋਣੀ ਚਾਹੀਦੀ ਹੈ ਔਰ ਜਿਹੜਾ ਡਰਾਈਵਰ ਉਹ ਵੀ ਵਧੀਆ ਹੋਣਾ ਚਾਹੀਦਾ ਨਾਲ ਮਦਦ ਕਰਨ ਵਾਲਾ ਹੋਣਾ ਚਾਹੀਦਾ ਕਿਉਂਕਿ ਮਾਤਾ ਜੀ ਬਜ਼ੁਰਗ ਹੈ ਹੈ ਨਾ ਉਹਨਾਂ ਦੇ ਗੋਡੇ ਗੁਡੇ ਦਰਦਾਂ ਦੁਰਦਾਂ ਹੁੰਦੀ ਹੈ ਅਤੇ ਵਿੱਚ ਵਾਰ ਕਿਤੇ ਰੋਕਣ ਰੁਕਣ ਦਾ ਵੀ ਪੈ ਸਕਦਾ ਹੈ ਨਾ ਜਿਹੜਾ ਡਰਾਈਵਰ ਹੈ ਉਹ ਸਮਝਣ ਵਾਲਾ ਹੋਣਾ ਚਾਹੀਦਾ ਨਾਲ ਜਲੰਧਰ ਤੋਂ ਲੁਧਿਆਣਾ ਦਾ ਸਫਰ ਹੈ ਵੀ ਬਹੁਤ ਦੂਰ ਹੈ ਔਰ ਨਾਲ ਉਹ ਬਿਮਾਰ ਵੀ ਰਹਿੰਦੇ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਹੁੰਦੀ ਔਰ ਕੈਬ ਮਤਲਬ ਵਧੀਆ ਹੋਣੀ ਚਾਹੀਦੀ ਹੈ ਡਰਾਈਵਰ ਵਧੀਆ ਹੋਣਾ ਚਾਹੀਦਾ ਜਿਹੜਾ ਓਨਾ ਵਧੀਆ ਤਰੀਕੇ ਨਾਲ ਗੱਲ ਕਰੇ ਉਹ ਰਸਤੇ ਰਸਤਾ ਰਸਤੇ ਦਾ ਪਤਾ ਨਾ ਲੱਗੇ ਕਿੱਦਾਂ ਕਿੱਦਾਂ ਗੱਲਾਂ ਗੁੱਲਾਂ ਕਰਦੇ ਨਿਕਲ ਗਿਆ ਬਸ ਇਹੀ ਸਭ ਜਾਣਕਾਰੀ ਦੱਸਣੀ ਸੀ ਔਰ ਕਿੰਨੇ ਪੈਸੇ ਲੈਣੇ ਆ ਤੁਸੀਂ ਕੈਬ ਦੇ ਪੰਜ ਹਜ਼ਾਰ ਪੰਜ ਹਜ਼ਾਰ ਤਾਂ ਬਹੁਤ ਹੈ ਅੰਕਲ ਜੀ ਚਲੋ ਕੋਈ ਨਹੀਂ ਵਧੀਆ ਕੈਬ ਹੋਣੀ ਚਾਹੀਦੀ ਹੈ ਪੈਸੇ ਜਿੰਨੇ ਮਰਜ਼ੀ ਹੋ ਜੇ ਉਹ ਤਾਂ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਧੰਨਵਾਦ